ਮੇਰੀ ਛੋਟੀ ਜਿਹੀ ਟਰੈਵਲ ਏਜੰਸੀ ਹੈ ਅੱਧੀ ਮੈਨੂੰ ਆਪਣਾ ਵਪਾਰਕ ਕੰਮ ਕਰਨ ਲਈ ਜੀਐਸਟੀ ਨੰਬਰ ਦੀ ਜ਼ਰੂਰਤ ਹੈ ਮੈਂ ਆਪਣੇ ਇੱਕ ਦੋਸਤ ਨੂੰ ਇੱਕ ਬਾਰੇ ਇਸ ਬਾਰੇ ਪੁੱਛਿਆ ਸੀ ਉਸਨੇ ਮੈਨੂੰ ਜੀਐਸਟੀ ਬਾਰੇ ਸਲਾਹ ਦਿੱਤੀ ਕੀ ਇਹ ਬਹੁਤ ਜ਼ਰੂਰੀ ਹੈ ਅਪਲਾਈ ਕਰਨਾ ਇਸ ਦੇ ਲਾਭ ਹਨ ਕਿ ਜਿਵੇਂ ਸਾਨੂੰ ਹਰ ਚੀਜ਼ ਜੀਐਸਟੀ ਲੱਗ ਕੇ ਮਿਲਦੀ ਹੈ ਉਹਨੇ ਮੈਨੂੰ ਇੱਦਾਂ ਦੱਸਿਆ ਜੀਐਸਟੀ ਨੰਬਰ ਹੋਣ ਅਤੇ ਸਾਨੂੰ ਜੀਐਸਟੀ ਲੱਗੀ ਹੋਈ ਰਕਮ ਵਾਪਸ ਆ ਜਾਵੇਗੀ ਪੰਜਾਬ ਵਿੱਚ ਸੀਜੀਐਸਟੀ ਅਤੇ ਐਸਜੀਐਸਟੀ ਐਸਜੀਐਸਟੀ ਲੱਗਦਾ ਹੈ ਅਗਰ ਪੰਜਾਬ ਤੋਂ ਬਾਹਰ ਦੇ ਲਿੰਕ ਕਿਤੇ ਜਾਵੇ ਤਾਂ ਆਈਜੀਐਸਟੀ ਵਰਤਿਆ ਜਾਂਦਾ ਹੈ ਜ਼ਿਆਦਾਤਰ ਪੰਜ ਪ੍ਰਸੈਂਟ ਅਤੇ ਅਠਾਰ੍ਹਾਂ ਪ੍ਰਸੈਂਟ ਜੀਐਸਟੀ ਦੀ ਵਰਤੋਂ ਹੁੰਦੀ ਹੈ ਮੇਰੇ ਦੋਸਤ ਨੇ ਮੈਨੂੰ ਜੀਐਸਟੀ ਅਪਲਾਈ ਕਰਨ ਦੇ ਕਾਫੀ ਲਾਭ ਦੱਸੇ ਹੁਣ ਮੈਂ ਵੀ ਜੀਐਸਟੀ ਅਪਲਾਈ ਕਰਨ ਦੇ ਪੱਖ ਵਿੱਚ ਹਾਂ ਬਹੁਤ ਜ਼ਰੂਰੀ ਹੈ ਉਹਨੇ ਮੈਨੂੰ ਦੱਸਿਆ ਜੀਐਸਟੀ ਕਰਨਾ ਅਪਲਾਈ ਕਰਨਾ ਅਤੇ ਹੁਣ ਮੈਂ ਜ਼ਰੂਰ ਅਪਲਾਈ ਕਰਾਂਗੀ ਅਤੇ ਮੈਂ ਦੇਖਦੀ ਹਾਂ ਆਪਣੇ ਘਰਦਿਆਂ ਨਾਲ ਵੀ ਸਲਾਹ ਕਰਦੀ ਹਾਂ